ਤੋਤਾ ਬਹੁਤ ਪਿਆਰਾ ਪੰਛੀ ਹੈ ਬੋਲਦਾ ਬਹੁਤ ਅੱਛਾ ਹੈ ਹਰ ਇੱਕ ਨੂੰ ਇਹ ਪਿਆਰਾ ਲੱਗਦਾ ਹੈ ਚਿ ਆਂ ਚਿ ਆਂ ਚਿ ਆਂ ਕਹਿੰਦਾ ਹੈ ਕਹਿੰਦਾ ਜੇ ਇਹਨੂੰ ਕੋਈ ਚੀਜ਼ ਸਿਖਾ ਦੇਈਏ ਤਾਂ ਉਹ ਵੀ ਉਹ ਸਿੱਖਦਾ ਬਹੁਤ ਅੱਛੀ ਤਰ੍ਹਾਂ ਸਿੱਖ ਲੈਂਦਾ ਜਿਨ੍ਹਾਂ ਨੇ ਘਰ ਰੱਖਿਆ ਹੁੰਦਾ ਉਨ੍ਹਾਂ ਲਈ ਉਹ ਕਹਿੰਦੇ ਉਹ ਆਪਣਾ ਮੰਤਰ ਜਿਹੜਾ ਉਹ ਵੀ ਤੋਤੇ ਨੂੰ ਸਿਖਾਉਂਦੇ ਰਾਮ ਰਾਮ ਰਾਮ ਰਾਮ ਵੀ ਕਹਿੰਦਾ ਮਿੱਠੂ ਮਿੱਠੂ ਮਿੱਠੂ ਕਹਿੰਦੇ ਹੁੰਦੇ ਤੋਤੇ ਨੂੰ ਮਿੱਠੂ ਵੀ ਕਹਿੰਦੇ ਹੈ ਤੋਤੇ ਨੂੰ ਮਿੱਠੂ ਵੀ ਕਹਿੰਦੇ ਹੈ ਅਤੇ ਇਸ ਕਰਕੇ ਤੋਤਾ ਜਿਹੜਾ ਨਾ ਉਹ ਬਹੁਤ ਹਰ ਇੱਕ ਨੂੰ ਬਹੁਤ ਪਿਆਰਾ ਲੱਗਦਾ ਹਰ ਇੱਕ ਬੋਲੀ ਬੋਲ ਲੈਂਦਾ ਸਾਰਿਆਂ ਦੀ ਪਛਾਣਦਾ ਕਰਦਾ ਇਸ ਕਰਕੇ ਤੋਤੇ ਨੂੰ ਸਾਰੇ ਬਹੁਤ ਪਸੰਦ ਕਰਦੇ ਪਿੰਜਰੇ 'ਚ ਪਾ ਕੇ ਰੱਖਦੇ ਤੋਤੇ ਨੂੰ ਬਾਹਰ ਵੀ ਮਤਲਬ ਲੋਕ ਦੇਖਣ ਜਾਂਦੇ ਹੈ ਜੂ ਵਿੱਚ ਦੇਖਣ ਜਾਂਦੇ ਹੈ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹੈਗੇ ਜੀ ਮਤਲਬ ਪਿੱਛੇ ਜਿਹੇ ਵਾਰ ਗਏ ਸੀ ਐਗਜ਼ੀਬਿਸ਼ਨ ਲੱਗਾ ਸੀ ਉੱਥੇ ਤੋਤੇ ਮੋਢਿਆਂ ਦੇ ਉੱਤੇ ਆ ਆ ਕੇ ਬਹਿੰਦੇ ਸੀ ਜਿਹੜੇ ਜਿਹੜੇ ਲੋਕ ਸੀ ਉਹਨੂੰ ਬਹੁਤ ਪਿਆਰ ਕਰਦੇ ਸੀ ਆ ਮਿੱਠੂ ਮਿੱਠੂ ਮਿੱਠੂ ਬੱਚੇ ਕਰਦੇ ਸੀ ਮਿੱਠੂ ਮਿੱਠੂ ਬੱਚੇ ਕਰਦੇ ਚੂਰੀ ਵੀ ਖਾ ਲੈਂਦਾ ਚੂਰੀ ਖਾ ਲਉ ਚੂਰੀ ਖਾ ਲਉ ਚੂ ਪਿੱਛੇ ਪਿੱਛੇ ਬੋਲੀ ਜਾਓ ਅਤੇ ਪਿੱਛੇ ਪਿੱਛੇ ਉਹ ਬੋਲਦਾ ਰਹਿੰਦਾ ਉਹ ਬਹੁਤ ਪਿਆਰਾ ਲੱਗਦਾ ਇਸ ਕਰਕੇ ਇਹਨੂੰ ਸਾਰੇ ਪਸੰਦ ਕਰਦੇ ਧੰਨਵਾਦ